ਨਵੀਨਤਮ ਤਕਨੀਕ ਰੋਜ਼ਾਨਾ ਜਾਂ ਖਬਰਾਂ ਅਸੀਂ ਮੋਬਾਈਲ ਲੈਪਟਾਪ ਜਾਂ ਅਸੀਂ ਸਮਾਰਟ ਵਾਚ ਰਾਹੀਂ ਪੜ੍ਹ ਸਕਦੇ ਹਾਂ ਉਹਦੇ ਨਾਲ ਹੀ ਅਸੀਂ ਅਪਡੇਟ ਰਹਿ ਸਕਦੇ ਹਾਂ ਅੱਜ ਦੇ ਸਮੇਂ ਵਿੱਚ ਨਿਊਜ਼ ਪੇਪਰ ਜਿਹੜਾ ਕਾਗਜ਼ ਨਾਲ ਬਣਾਇਆ ਜਾਂਦਾ ਹੈ ਉਸ ਦੀ ਵਰਤੋਂ ਘੱਟ ਰਹੀ ਹੈ ਜਿਹੜਾ ਨਿਊਜ਼ ਪੇਪਰ ਮੋਬਾਇਲ 'ਤੇ ਦੇਖਿਆ ਜਾਂਦਾ ਹੈ ਉਹਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਮੈਂ ਜੋ ਨਵੀਂ ਖਬਰ ਪੜ੍ਹੀ ਸੀ ਅੱਜ ਸ਼ਾਮ ਨੂੰ ਆਸਟਰੇਲੀਆ ਅਤੇ ਇੰਡੀਆ ਦਾ ਵਰਲਡ ਕੱਪ ਮੈਚ ਖੇਡਿਆ ਜਾਣਾ ਹੈ ਕ੍ਰਿਕਟ ਮੈਚ ਖੇਡਿਆ ਜਾਣਾ ਹੈ ਜੋ ਕਿ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਮਨੋਰੰਜਨ ਭਾਉ ਪ੍ਰੋਗਰਾਮ ਹੈ ਅੱਜ ਦੀ ਲੇਟੈਸਟ ਅਪਡੇਟ ਨਿਊਜ਼ ਪੇਪਰ 'ਤੇ ਵਿਸ਼ਵ ਯੁੱਧ ਦੇ ਬਾਰੇ ਵਿੱਚ ਪੜ੍ਹੀ ਹੈ ਜੋ ਕਿ ਬੜੀ ਭਿਆਨਕ ਹੈ ਜਿਸ ਨਾਲ ਸਾਨੂੰ ਬੜੀ ਘਬਰਾਹਟ ਹੁੰਦੀ ਹੈ ਨਵੀਨਤਨ ਤਕਨੀਕ ਦਾ ਸਹਾਰਾ ਲੈ ਕੇ ਅਸੀਂ ਆਪਣੇ ਆਪ ਨੂੰ ਅਪਡੇਟ ਤਾਂ ਕਰਦੇ ਹਾਂ ਲੇਕਿਨ ਨਵੀਤਮ ਤਕਨੀਕ ਨਾਲ ਅਸੀਂ ਆਪਣੇ ਆਪ ਨੂੰ ਖਰਾਬ ਵੀ ਕਰ ਰਹੇ ਹਾਂ ਨਵੀਨਤਮ ਤਕਨੀਕ ਦੁਆਰਾ ਅਸੀਂ ਆਪਣੇ ਆਪ ਨੂੰ ਹਰ ਸਮੇਂ ਹਰ ਵਿਸ਼ਵ ਦੇ ਹਰ ਪ੍ਰਕਰਨ ਵਿੱਚ ਦੇਖ ਸਕਦੇ ਹਾਂ ਪੜ੍ਹ ਸਕਦੇ ਹਾਂ ਰਹਿ ਸਕਦੇ ਹਾਂ ਲੇਕਿਨ ਨਵੀਨਤਮ ਤਕਨੀਕ ਦੇ ਨਾਲ ਜਿਹੜੀ ਅਪਡੇਟ ਅਸੀਂ ਰੋਜ਼ ਵੇਖਦੇ ਹਾਂ ਉਹਦਾ ਸਾਡੇ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ